ਹੈਲੋ ਮੈਂ ਹਰਮਨਜੀਤ ਕੌਰ ਮੈਂ ਤੁਹਾਡੇ ਮੀਸ਼ੂ ਐਪ ਤੋਂ ਮੈਂ ਤੁਹਾਡਾ ਮਿਸ਼ੂ ਐਪ ਖੋਲਿਆ ਅਤੇ ਮੈਂ ਉਸ ਵਿੱਚ ਕੁਝ ਪ੍ਰੋਡਕਟ ਦੇਖ ਰਹੀ ਸੀ ਜਿਸ ਵਿੱਚ ਮੈਨੂੰ ਕੁਝ ਮੈਨੂੰ ਸ਼ੂਜ਼ ਵਧੀਆ ਲੱਗੇ ਬਲੇ ਮੈਂ ਅਤੇ ਮੈਂ ਉਸ ਪ੍ਰੋਡਕਟ ਨੂੰ ਦੇਖ ਕੇ ਉਹ ਸ਼ੂਜ਼ ਨੂੰ ਔਡਰ ਕੀਤਾ ਅਤੇ ਉਹ ਬਲੈਕ ਕਲਰ ਦੇ ਸਨ ਮੈਨੂੰ ਉਹ ਸ਼ੂਜ਼ ਬਹੁਤ ਵਧੀਆ ਲੱਗੇ ਅਤੇ ਮੈਂ ਉਹਨਾਂ ਨੂੰ ਔਡਰ ਕਰ ਦਿੱਤਾ ਮੇਰੇ ਪ੍ਰੋਡਕਟ ਮਿੱਥੇ ਤੋਂ ਦਿੱਤੀ ਡੇਟ ਤੋਂ ਪਹਿਲਾਂ ਹੀ ਆ ਗਿਆ ਜਿਸ ਵਿੱਚ ਮੈਂ ਜਦੋਂ ਉਹਨਾਂ ਨੂੰ ਖੋਲ ਕੇ ਦੇਖਿਆ ਅਤੇ ਉਹ ਬਹੁਤ ਹੀ ਵਧੀਆ ਸਨ ਬਹੁਤ ਹੀ ਸੁੰਦਰ ਸਨ ਜਦੋਂ ਜਿਹੜਾ ਕਲਰ ਮੈਂ ਮੰਗਵਾਇਆ ਸੀ ਉਹੀ ਕਲਰ ਆਇਆ ਜਦੋਂ ਮੈਂ ਜਦੋਂ ਮੈਂ ਇਹਨਾਂ ਨੂੰ ਦੇਖਿਆ ਅਤੇ ਇਹ ਬਹੁਤ ਹੀ ਵਧੀਆ ਸਨ ਅਤੇ ਮੇਰੀਆਂ ਸਹੇਲੀਆਂ ਨੇ ਵੀ ਇਹਨਾਂ ਦੀ ਬਹੁਤ ਹੀ ਤਾਰੀਫ ਤਾਰੀਫ ਕੀਤੀ ਤਾਰੀਫ ਕੀਤੀ ਅਤੇ ਇਹ ਸ਼ੂਜ਼ ਬਹੁਤ ਹੀ ਬਹੁਤੇ ਹੀ ਵਧੀਆ ਨਿਕਲੇ